ਚੋਣਾਂ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਵੈ ਕਰਨਾ ਪਿਆ ਸੀ ਜਿਸ ਤਰ੍ਹਾਂ ਕਿ ਇਸ ਵਾਰ ਚੋਣਾਂ ਦੇ ਦੌਰਾਨ ਬਹੁਤ ਜ਼ਿਆਦਾ ਗਰਮੀ ਸੀ ਔਰ ਗਰਮੀ ਹੋਣ ਦੇ ਕਾਰਨ ਲੋਕ ਲੋਕਾਂ ਦਾ ਚੋਣਾਂ ਦੇ ਉਹਨਾਂ ਵੀ ਗਿਣਤੀ ਵੀ ਘੱਟ ਹੋ ਜਾਂਦੀ ਹੈ ਉਹਦੇ ਕਰਕੇ ਉੱਥੇ ਕੋਈ ਸੁਵਿਧਾਵਾਂ ਕੁਛ ਖਾਸ ਨਹੀਂ ਮਿਲਦੀਆਂ ਜਿਸ ਤਰ੍ਹਾਂ ਕਿ ਅੰਦਰ ਜਦੋਂ ਲੋਕ ਆਉਂਦੇ ਨੇ ਉਹਨਾਂ ਦੇ ਲਈ ਕੋਈ ਅੱਛਾ ਪ੍ਰਬੰਧ ਜਾਂ ਅੱਛੇ ਤਰੀਕੇ ਨਾਲ ਉਹਨਾਂ ਨੂੰ ਪਾਣੀ ਵਗੈਰਾ ਨਹੀਂ ਦਿੱਤਾ ਜਾਂਦਾ ਸੋ ਮੈਨੂੰ ਲੱਗਦਾ ਏ ਚੋਣਾਂ ਦੇ ਦੌਰਾਨ ਲੋਕਾਂ ਦੀ ਸੇਫਟੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਚੋਣ ਇੱਕ ਨੋਰਮਲ ਹੀ ਵੋਟ ਪਾਉਣਾ ਹੀ ਨਹੀਂ ਬਲਕੀ ਆਪਨੇ ਆਪਣੇ ਲਈ ਇੱਕ ਅੱਛਾ ਨੇਤਾ ਚੁਣਨਾ ਔਰ ਸਰਕਾਰ ਦੇ ਆਪਣੇ ਦੇਸ਼ ਦੀ ਤਰੱਕੀ ਲਈ ਅੱਛਾ ਨੇਤਾ ਚੁਣ ਕੇ ਕੋਂਟਰੀਬਿਊਟ ਕਰਨਾ ਹੁੰਦਾ ਹੈ ਸੋ ਸਾਨੂੰ ਚਾਹੀਦਾ ਹੈਗਾ ਹੈ ਕਿ ਅਗਰ ਅਸੀਂ ਚੋਣਾਂ ਕਰਵਾ ਰਹੇ ਹਾਂ ਚੋਣਾਂ ਹੋ ਰਹੀਆਂ ਨੇ ਚੋਣਾਂ ਦੇ ਦੌਰਾਨ ਜੋ ਸਾਡਾ ਕੋਰਡੀਨੇਟਰ ਜੋ ਸਾਡਾ ਮਤਲਬ ਉੱਥੋਂ ਦਾ ਅੰਚਾਰਜ ਹੋਏ ਉਹ ਜਾਂ ਕੋਈ ਵੀ ਹੈਡ ਹੋਏ ਜਿਹਨੂੰ ਜਿਹੜਾ ਵੀ ਪਿੰਡ ਸੌਂਪਿਆ ਜਾਂਦਾ ਉਹਦਾ ਫਰਜ਼ ਬਣਦਾ ਹੈ ਕਿ ਉੱਥੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਕਿ ਲੋਕਾਂ ਨੂੰ ਇੰਨੀ ਗਰਮੀ ਨਾ ਹੋਏ ਲੱਗੇ ਉੱਥੇ ਸੋ ਉਹਦਾ ਉਹਦੇ ਨਾਲ ਨਾਲ ਅਨੁਸ਼ਾਸਨ 'ਤੇ ਚਲੋ ਹਰ ਵਾਰ ਦੇਖਣ ਨੂੰ ਅੱਜ ਕੱਲ੍ਹ ਕਾਫੀ ਸੁਧਾਰ ਮਿਲਿਆ ਕਿ ਲੋਕਾਂ ਨੂੰ ਲਾਈਨਾਂ 'ਚ ਲਗਾਇਆ ਜਾਂਦਾ ਹੈ ਅਤੇ ਪਲਸ ਇੱਕ ਉਹ ਵੀ ਚਾਹੁੰਦੀ ਹਾਂ ਕਿ ਜੋ ਔਰਤਾਂ ਇੱਕ ਬੱਚੇ ਦੇ ਨਾਲ ਹੁੰਦੇ ਛੋਟੇ ਬੱਚੇ ਦੇ ਨਾਲ ਹੁੰਦੇ ਉਹਨਾਂ ਦੇ ਲਈ ਅਲੱਗ ਤੋਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਕਿ ਉਹਨਾਂ ਨੂੰ ਲਾਈਨ 'ਚ ਖੜ੍ਹਾ ਕਰਨ ਨੂੰ ਨਾ ਮਿਲੇ ਜੋ ਸਾਡੀਆਂ ਮਾਤਾਵਾਂ ਜਾਂ ਸਾਡੀਆਂ ਭੈਣਾਂ ਜਿਹਨਾਂ ਨੂੰ ਸਰੀਰਕ ਤੌਰ 'ਤੇ ਪ੍ਰੋਬਲਮ ਹੁੰਦੀ ਏ ਜਿਵੇਂ ਕਿਸੇ ਨੂੰ ਕਿਸੇ ਕੋ ਗੋਡਿਆਂ ਦੀ ਪ੍ਰੋਬਲਮ ਹੁੰਦੀ ਹੈ ਜ਼ਿਆਦਾਤਰ ਲੋਕਾਂ ਕੋਲ ਤੁਰਿਆ ਨਹੀਂ ਜਾਂਦਾ ਸੋ ਉਹਨਾਂ ਦੇ ਲਈ ਬੈਠਣ ਦਾ ਪ੍ਰਬੰਧ ਵੀ ਉੱਥੇ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਜਿਹੜੇ ਨੇ ਬਿਨਾਂ ਕਿਸੇ ਕਸ਼ਟ ਦੇ ਆਰਾਮ ਨਾਲ ਖੁਸ਼ੀ ਖੁਸ਼ੀ ਵੋਟ ਪਾ ਸਕਨ ਅਤੇ ਲੋਕਾਂ ਨੂੰ ਜ਼ਿਆਦਾ ਗਰਮੀ ਔਰ ਜ਼ਿਆਦਾ ਉਹਦਾ ਨਾ ਪ੍ਰਬੰਧ ਕਰਨਾ ਪਵੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਗਾ ਹੈ